ਜਿਵੇਂ ਕਿ ਮੈਂ ਮੋਹਾਲੀ ਦੀ ਰਹਿਣ ਵਾਲੀ ਹਾਂ ਸਾਡੇ ਖੇਤਰ ਦੇ ਵਿੱਚ ਸੱਤਰ ਸੈਕਟਰ ਵਿੱਚ ਸ਼ਹੀਦਾਂ ਦਾ ਗੁਰਦੁਆਰਾ ਸ਼੍ਰੀ ਗੁਰਦੁਆਰਾ ਸ਼੍ਰੀ ਸੋਹਾਣਾ ਸਾਹਿਬ ਹੈ ਜੋ ਕਿ ਸ਼ਹੀਦ ਹਨੂੰਮਾਨ ਸਾਹਿਬ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਇਹਨਾਂ ਦਾ ਸਾਡੀ ਦੇਸ਼ ਦੀ ਆਜ਼ਾਦੀ ਲਈ ਬਹੁਤ ਵੱਡਾ ਯੋਗਦਾਨ ਰਿਹਾ ਹੈ ਇੱਕ ਗੁਰਦੁਆਰਾ ਸਾਹਿਬ ਸੱਤ ਫੇਸ ਵਿੱਚ ਬਣਾਇਆ ਗਿਆ ਹੈ ਜਿਸਦਾ ਨਾਮ ਅੰਬ ਸਾਹਿਬ ਹੈ ਜੋ ਕਿ ਸੱਤਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਰਾਏ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਚੱਪੜਚਿੜੀ ਫਤਿਹ ਬੁਰਜ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਇਹਨਾਂ ਸਾਰੀਆਂ ਜਿਹੜੇ ਸਥਾਨਾਂ ਦੇ ਉੱਪਰ ਹੈ ਲੋਕ ਘੁੰਮਣ ਆਉਂਦੇ ਹਨ ਜਿਸ ਦੇ ਨਾਲ਼ ਕਿ ਬਹੁਤ ਸਾਰੇ ਸੈਲਾਨੀ ਆ ਜਿਹੜੇ ਆਉਂਦੇ ਨੇ ਇੰਨਜੋਏ ਕਰਦੇ ਨੇ ਫੋਟੋਆਂ ਖਿਚਾਉਂਦੇ ਨੇ ਅਤੇ ਆਪਣਾ ਜਿਹੜਾ ਇੱਕ ਆਨੰਦ ਮਾ ਮਾਣ ਮਹਿਸੂਸ ਕਰਦੇ ਨੇ ਸਾਨੂੰ ਇਸ ਖੇਤਰ ਦੇ ਵਿੱਚ ਸਾਡੇ ਕੁਦਰਤੀ ਜਿਹੜੇ ਇਹ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਸੈਲਾਨੀ ਘੁੰਮਣ ਆਉਂਦੇ ਹਨ ਅਤੇ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਜਦੋਂ ਹੋਰ ਪਾਸੇ ਤੋਂ ਲੋਕ ਇੱਧਰ ਘੁੰਮਣ ਆਉਂਦੇ ਹਨ ਇੱਥੇ ਇੱਕ ਸਟੇਡੀਅਮ ਵੀ ਹੈ ਬਿੰਦਰਾ ਸਟੇਡੀਅਮ ਜਿੱਥੇ ਕਿ ਜੋ ਕਿ ਕ੍ਰਿਕਟ ਦਾ ਸਟੇਡੀਅਮ ਹੈ ਇੱਥੇ ਕ੍ਰਿਕਟ ਦੇ ਸਟੇਡੀਅਮ ਦੇ ਵਿੱਚ ਸਪੋਰਟਸ ਨੂੰ ਵੀ ਪ੍ਰਮੋਟ ਕੀਤਾ ਜਾਂਦਾ ਹੈ ਜਿਵੇਂ ਕਿ ਇੱਥੇ ਕਈ ਜਿਹੜੇ ਲੋਕ ਹੈ ਕ੍ਰਿਕਟ ਜਿਹੜੀ ਹੈ ਲਾਈਵ ਦੇਖਣ ਆਉਂਦੇ ਹਨ ਜਿਸ ਦੇ ਨਾਲ ਬਹੁਤ ਹੀ ਜ਼ਿਆਦਾ ਭਾਰੀ ਮਾਤਰਾ ਦੇ ਵਿੱਚ ਮਤਲਬ ਬਿਜਨਸ ਇੱਕ ਤਰ੍ਹਾਂ ਬਿਜਨਸ ਦੇ ਵਿੱਚ ਪ੍ਰਮੋਸ਼ਨ ਹੁੰਦੀ ਹੈ ਇੱਥੇ ਇੱਕ ਐੱਨ ਸੀ ਐੱਮ ਮੋਲ ਵੀ ਹੈ ਜਿੱਥੇ ਕਿ ਲੋਕ ਘੁੰਮਣ ਆਉਂਦੇ ਹਨ ਅਲੱਗ ਅਲੱਗ ਤਰ੍ਹਾਂ ਦੇ ਬ੍ਰੈਂਡ ਇੱਕੋ ਹੀ ਛੱਤ ਦੇ ਨੀਚੋਂ ਆਪਾਂ ਨੂੰ ਮਿਲ ਸਕਦੇ ਹਨ ਲੋਕ ਖਾਣ ਪੀਣ ਆਉਂਦੇ ਹਨ ਅਤੇ ਫੋਟੋਆਂ ਖਿਚਾਉਂਦੇ ਹਨ ਓਵਰਆਲ ਮੋਹਾਲੀ ਇੱਕ ਇਹ ਇਹ ਇਹੋ ਜਿਹਾ ਸ਼ਹਿਰ ਹੈ ਜਿੱਥੇ ਸਾਰੇ ਤਰ੍ਹਾਂ ਦੇ ਜੋ ਜੋ ਵੀ ਆਪਾਂ ਨੂੰ ਚੀਜ਼ ਚਾਹੀਦੀ ਹੈ ਜਿਸ ਵੀ ਤਰ੍ਹਾਂ ਦੀ ਇੰਨਜੋਏਮੈਂਟ ਆਪਾਂ ਨੂੰ ਚਾਹੀਦੀ ਹੈ ਉਸ ਤਰ੍ਹਾਂ ਦੀ ਇੰਨਜੋਏਮੈਂਟ ਆਪਾਂ ਪ੍ਰਾਪਤ ਕਰ ਸਕਦੇ ਹਾਂ ਗੁਰਦੁਆਰਾ ਸਾਹਿਬ ਤੋਂ ਲੈ ਕੇ ਆਪਾਂ ਮੱਥਾ ਟੇਕਣ ਤੋਂ ਬਿਨਾਂ ਅਸੀਂ ਹੋਰ ਵੀ ਬਹੁਤ ਜਿਹੜੀ ਹੈ ਥਾਵਾਂ 'ਤੇ ਘੁੰਮ ਸਕਦੇ ਹਾਂ ਪਰ ਪਰ ਸਭ ਤੋਂ ਪ੍ਰਸਿੱਧ ਇੱਥੇ ਦਾ ਸ ਸੱਤਰ ਸੈਕਟਰ ਦਾ ਗੁਰਦੁਆਰਾ ਗੁਰਦੁਆਰਾ ਸ਼੍ਰੀ ਸੋਹਾਣਾ ਸਾਹਿਬ